ਹਾਂਜੀ ਮੈਮ ਬੋਲੋ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ

ਅੱਛਾ ਮੈਮ ਤੁਹਾਡਾ ਕਿਹੜਾ ਏਰੀਏ ਜੀ ਓਕੇ ਐਕਚੁਲੀ ਮੈਮ ਸਾਡੇ ਨਾ ਜੀ ਇੱਕ ਟੀਮ ਸਰਚ ਲੱਗੀ ਹੋਈ ਆ ਵਰਕ 'ਤੇ ਅਤੇ ਉਹ ਪਿੰਡਾਂ 'ਚ ਜਾ ਜਾ ਕੇ ਸਾਡੀ ਡਿਊਟੀਆਂ ਲੱਗੀਆਂ ਹੋਈਆਂ ਸਾਰੇ ਪਾਸੇ ਜੀ ਅਤੇ ਉਹ ਆਪਣਾ ਕੰਮ ਕਰੀ ਜਾਂਦੇ ਨੇ ਜੀ ਹਰ ਪਾਸੇ ਨਾਕੇ ਬੰਦੀ ਕਰ ਰੱਖੀ ਹੈਗੀ ਆ ਅਸੀਂ ਅਤੇ ਜੇਕਰ ਫਿਰ ਵੀ ਤੁਹਾਡੇ ਕੋਲ ਕੋਈ ਇਨਕੁਇਰੀ ਆਉਂਦੀ ਹੈਗੀ ਆ ਤੁਹਾਨੂੰ ਕੋਈ ਲੱਗਦਾ ਸ਼ੱਕ ਦੇ ਆਧਾਰ 'ਤੇ ਤਾਂ ਤੁਸੀਂ ਸਾਡੇ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ ਜੀ ਤੁਹਾਡਾ ਨਾਮ ਅਤੇ ਤੁਹਾਡਾ ਪਤਾ ਗੁਪਤ ਰੱਖਿਆ ਜਾਊਗਾ ਅਜਿਹੀ ਕੋਈ ਚੱਕਰ ਵਾਲੀ ਗੱਲ ਨਹੀਂ

ਮੈਮ ਮੈਂ ਕਹਿ ਤਾਂ ਸਾਡੀ ਸਪੈਸ਼ਲ ਟੀਮ ਲਾ ਰੱਖਿਆ ਇੱਕ ਜੀ ਸਾਡਾ ਇੱਕ ਸਪੈਸ਼ਲ ਗਰੁੱਪ ਬਣਿਆ ਹੋਇਆ ਡਰੱਗ ਨੂੰ ਰੋਕਣ ਵਾਸਤੇ ਜਿਹੜਾ ਹਰ ਪਿੰਡ ਜਾ ਕੇ ਛਾਪੇ ਮਾਰ ਰਿਹਾ ਹੈਗਾ ਵੀ ਕਿਹੜਾ ਬੰਦਾ ਵੇਚ ਰਿਹਾ ਗਾ ਅਤੇ ਕਿਹੜਾ ਬੰਦਾ ਅੱਗੇ ਹੈਲਪ ਕਰ ਰਿਹਾ ਹੈਗਾ ਠੀਕ ਆ ਜੀ ਬਾਕੀ ਤੁਹਾਡੇ ਪਿੰਡਾਂ ਦੇ ਵੀ ਆਪਾਂ ਸਾਥ ਚਾਹੀਦਾ ਜੀ ਤਾਂ ਸਾਥ ਦਿਓ ਕੋਈ ਗੱਲ ਨਹੀਂ ਅਤੇ ਬਾਕੀ ਤੁਸੀਂ ਕੋਈ ਗੱਲ ਨਹੀਂ ਇਸੇ ਤਰ੍ਹਾਂ ਟੀਮ ਭੇਜ ਦਿੰਦੇ ਹੈਗੇ ਅਤੇ ਸਾਨੂੰ ਦੱਸ ਦਿਓ ਕੋਈ ਨਾ ਓਕੇ ਮੈਮ